ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਮੈਂ ਪਰਵਿੰਦਰਪਾਲ ਤੁਹਾਡੀ ਏਜੰਸੀ ਤੋਂ ਮੈਂ ਕੈਬ ਬੁੱਕ ਕਰਵਾਈ ਸੀਗੀ ਹਾਲੇ ਦਸ ਕੁ ਮਿੰਟ ਪਹਿਲਾਂ ਹੀ ਤਾਂ ਤੁਹਾਡੇ ਡਰਾਈਵਰ ਦਾ ਇਹ ਮੈਸੇਜ਼ ਆਇਆ ਸੀਗਾ ਵੀ ਮੈਂ ਤੁਹਾਡੀ ਤੋਂ ਬਹੁਤ ਨੇੜੇ ਦੇ ਅਸਥਾਨ 'ਤੇ ਹੀ ਖੜਾਂ ਅਤੇ ਮੈਂ ਪੰਜ ਮਿੰਟ ਬਾਅਦ ਤੁਹਾਡੇ ਕੋਲ ਪਹੁੰਚ ਜਾਵਾਂਗਾ ਪਰ ਪੰਦਰ੍ਹਾਂ ਮਿੰਟ ਜਿਹੜੇ ਐਂ ਲੰਘ ਚੁੱਕੇ ਨੇ ਪਰ ਹਾਲੇ ਤੱਕ ਜਿਹੜਾ ਤੁਹਾਡਾ ਡਰਾਈਵਰ ਹੈ ਓਸ ਦਾ ਦੁਬਾਰਾ ਨਾ ਕੋਈ ਫ਼ੋਨ ਆਇਆ ਅਤੇ ਨਾ ਹੀ ਕੋਈ ਮੈਨੂੰ ਮੈਸੇਜ਼ ਆਇਆ ਮੈਂ ਐਮਰਜੈਂਸੀ ਦੇ ਵੀ ਵਿੱਚ ਕਿਤੇ ਜ ਜਾਣਾ ਔਰ ਜਲਦੀ ਟਾਈਮਲੀ ਪਹੁੰਚਣਾ ਸੋ ਇਸ ਕਰਕੇ ਮੈਨੂੰ ਦੱਸਿਆ ਜਾਵੇ ਵੀ ਕੀ ਤੁਹਾਡਾ ਡਰਾਈਵਰ ਆਵੇਗਾ ਅਗਰ ਉਹ ਨਹੀਂ ਆਵੇਗਾ ਤਾਂ ਮੇਰੀ ਜਿਹੜੀ ਡਰਾਈਵ ਹੈ ਉਹ ਕੈਂਸਲ ਕਰ ਦਿੱਤੀ ਜਾਵੇ ਤਾਂ ਕਿ ਮੈਂ ਕਿਸੇ ਹੋਰ ਸਾਧਨ ਦੇ ਰਾਹੀਂ ਜਿਸ ਮੁਕਾਮ 'ਤੇ ਮੈਂ ਪਹੁੰਚਣਾ ਉੱਥੇ ਮੈਂ ਪਹੁੰਚ ਸਕਾ